ਤੈਰਾਕੀ ਕਰਨਾ ਇੱਕ ਖੇਡ ਵੀ ਹੈ ਅਤੇ ਤੈਰਾਕੀ ਕਰਨਾ ਇੱਕ ਸ਼ੌਕ ਵੀ ਹੈ ਕੁਝ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੀ ਤੈਰਾਕੀ ਕਰਦੇ ਹਨ ਅਤੇ ਕੁਝ ਲੋਕ ਸ਼ੌਕ ਵਜੋਂ ਕਦੇ ਕਦੇ ਤੈਰਾਕੀ ਕਰਦੇ ਹਨ ਤੈਰਾਕੀ ਤੰਦਰੁਸਤ ਸਰੀਰ ਲਈ ਇੱਕ ਬਹੁਤ ਹੀ ਵਧੀਆ ਚੀਜ਼ ਹੈ ਤੰਦਰੁਸਤ ਸਰੀਰ ਇਸ ਪ੍ਰਕਾਰ ਹੁੰਦਾ ਹੈ ਕਿਉਂਕਿ ਜਦ ਆਪਾਂ ਤੈਰਾਕੀ ਕਰਦੇ ਹਾਂ ਤਦ ਆਪਣੇ ਸਾਰੇ ਅੰਗ ਪੈਰ ਖੁੱਲ੍ਹਦੇ ਹਨ ਅਤੇ ਤੈਰਾਕੀ ਲਈ ਜ਼ੋਰ ਅਤੇ ਸ਼ਮਤਾ ਵੀ ਜ਼ਰੂਰੀ ਹੈ ਤਾਂ ਤੈਰਾਕੀ ਸਰੀਰ ਨੂੰ ਚੰਗੀ ਤਰ੍ਹਾਂ ਖੋਲ੍ਹ ਦਿੰਦੀ ਹੈ ਤੈਰਾਕੀ ਦੇ ਨਾਲ ਆਪਾਂ ਨੇ ਸਾਹਾਂ 'ਤੇ ਵੀ ਨਿ ਆਪਾਂ ਆਪਣੇ ਸਾਹਾਂ 'ਤੇ ਵੀ ਨਿਯੰਤਰਨ ਪਾਉਂਦੇ ਹਾਂ ਜਦ ਆਪਾਂ ਨੂੰ ਕਈ ਕਈ ਮਿੰਟ ਤੈਰਾਕੀ ਕਰਨੀ ਪੈਂਦੀ ਹੈ ਤਾਂ ਸਾਹ ਸਾਹਾਂ 'ਤੇ ਨਿਯੰਤਰਨ ਆਉਂਦਾ ਹੈ ਅਤੇ ਸਾਹ ਜ਼ਿਆਦਾ ਚੜ੍ਹਦਾ ਹੈ ਤਾਂ ਤਦ ਉਸਦੀ ਵਾਰ ਵਾਰ ਪ੍ਰੈਕਟਿਸ ਕਰਨ ਦੇ ਨਾਲ ਆਪਾਂ ਨੂੰ ਆਪਾਂ ਨੂੰ ਸਾਹਾਂ 'ਤੇ ਨਿਯੰਤਰਨ ਮਿਲ ਜਾਂਦਾ ਹੈ ਇਹ ਮਨ ਨੂੰ ਸ਼ਾਂਤ ਰਹਿਣਾ ਵੀ ਸਿਖਾਉਂਦੀ ਹੈ ਕਿਉਂਕਿ ਜਦ ਆਪਾਂ ਤੈਰਾਕੀ ਕਰਦੇ ਹਾਂ ਤਾਂ ਮਨ ਸ਼ਾਂਤ ਰੱਖ ਕੇ ਹੀ ਤੈਰਾਕੀ ਸਹੀ ਤੈਰਾਕੀ ਹੁੰਦੀ ਹੈ ਕਿਉਂਕਿ ਹੜਬੜਾਹਟ ਦੇ ਵਿੱਚ ਬੰਦਾ ਡੁੱਬ ਸਕਦਾ ਹੈ ਅਤੇ ਜ਼ਿਆਦਾ ਕਾਹਲ ਨਾਲ ਵੀ ਬੰਦਾ ਡੁੱਬ ਸਕਦਾ ਹੈ ਇਸ ਲਈ ਸ਼ਾਂਤੀ ਰੱਖਣੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਆਪਣੇ ਮਨ ਉੱਤੇ ਕਾਬੂ ਪਾਉਣਾ ਜ਼ਰੂਰੀ ਹੈ ਇਸ ਲਈ ਤੈਰਾਕੀ ਆਪਾਂ ਨੂੰ ਮਨ ਅਤੇ ਸਰੀਰ ਦੋਨਾਂ 'ਤੇ ਕਾਬੂ ਪਾਉਣਾ ਸਿਖਾਉਂਦੀ ਹੈ ਤਾਂ ਸਰੀਰ ਆਪਣਾ ਤੰਦਰੁਸਤ ਰਹਿੰਦਾ ਹੈ ਤਨੋਂ ਅਤੇ ਮਨੋਂ ਵੀ